ਹੈਲੋ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਤੁਸੀਂ ਠੀਕ ਹੈ ਜੀ ਹਾਂਜੀ ਅਤੇ ਮੈਂ ਨਾ ਤੁਹਾਨੂੰ ਪੁੱਛਣਾ ਸੀ ਪੁੱਛਣਾ ਸੀ ਵੀ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਕਿਹੜੇ ਕਿਹੜੇ ਮਤਲਬ ਕਿ ਰੱਖਿਆ ਹੋਇਆ ਮੀਟ ਫਿਸ਼ ਹਾਂਜੀ ਮਤਲਬ ਕਿ ਰੇਟ ਕੀ ਇਹਦਾ ਫਿਸ਼ ਦਾ ਕੀ ਰੇਟ ਹੈ ਔਰ ਆਪਣੇ ਮਤਲਬ ਕਿ ਚਿਕਨ ਦਾ ਮਟਨ ਦਾ ਠੀਕ ਹੈ ਜੀ ਠੀਕ ਹੈ ਮਤਲਬ ਕਿ ਮਤਲਬ ਜਿਸ ਤਰ੍ਹਾਂ ਆਪਣੇ ਅਲੱਗ ਲੈੱਗ ਪੀਸ ਵਗੈਰਾ ਵੀ ਮਿਲ ਜਾਂਦੇ ਹੈ ਹਾਂਜੀ ਠੀਕ ਹੈ ਉਹ ਮਤਲਬ ਵੀ ਫਰੈਸ਼ ਆ ਨਾ ਤੁਹਾਡੇ ਕੋਲ ਸਾਰਾ ਸਮਾਨ ਠੀਕ ਹੈ ਜੀ ਕਿਉਂਕਿ ਮੈਂ ਹਾਂਜੀ ਮੈਂ ਆਰਡਰ ਕਰਨਾ ਸੀ ਮੈਨੂੰ ਤੁਹਾਡੀ ਸ਼ੋਪ ਬਾਰੇ ਕਿਸੇ ਨੇ ਦੱਸਿਆ ਸੀ ਕਿ ਉਥੋਂ ਮਤਲਬ ਸੀ ਅੱਛਾ ਹੀ ਮਿਲਦਾ ਇਸ ਕਰਕੇ ਮੈਂ ਕਿਹਾ ਕਿ ਮੈਂ ਉਹਨਾਂ ਨੂੰ ਪੁੱਛਦੀ ਹਾਂ ਬਾਕੀ ਕਿਸ ਤਰ੍ਹਾਂ ਹਾਂਜੀ ਔਰ ਕਿਹੜੀ ਸਾਈਡ 'ਤੇ ਤੁਹਾਡੀ ਸ਼ੋਪ ਪੈਂਦੀ ਹੈ ਹਾਂਜੀ ਠੀਕ ਹੈ ਜੀ ਅੱਛਾ ਮਤਲਬ ਕਿ ਚੌਵੀ ਘੰ ਮਤਲਬ ਕਾਫੀ ਕਿੰਨੀ ਦੇਰ ਤੱਕ ਖੁੱਲ੍ਹੀ ਰਹੇਗੀ ਤੁਹਾਡੀ ਸ਼ੋਪ ਹਾਂਜੀ ਠੀਕ ਹੈ ਮਤਲਬ ਕਿ ਜਿਸ ਤਰ੍ਹਾਂ ਮੈਂ ਆਰਡਰ ਕਰਨੀ ਹੈ ਅਤੇ ਤੁਸੀਂ ਮਤਲਬ ਡਿਲੀਵਰੀ ਘਰ ਹੀ ਮਤਲਬ ਪਹੁੰਚਾ ਦੋਗੇ ਅੱਛਾ ਜੀ ਮਤਲਬ ਕਿ ਇਹ ਹੈ ਕਿ ਸਾਨੂੰ ਮਤਲਬ ਕਿ ਸਾਡੇ ਫੰਕਸ਼ਨ ਹੈ ਸਾਨੂੰ ਅੱਛੀ ਮਤਲਬ ਕਿ ਵਰਾਇਟੀ ਚਾਹੀਦੀ ਹੈ ਹਮ ਹਮ ਫਿਸ਼ ਮਤਲਬ ਕਿ ਇੱਕ ਹੀ ਤਰ੍ਹਾਂ ਦੀ ਹੈ ਕਿ ਜਾਂ ਮਤਲਬ ਕੋਈ ਹੋਰ ਵੀ ਕੋਈ ਹੈ ਹਮ ਹਮ ਅੱਛਾ ਜੀ ਚਲੋ ਠੀਕ ਠੀਕ ਹੈ ਜੀ ਮੈਂ ਤੁਹਾਨੂੰ ਆਡਰ ਕਰ ਦਿੰਦੀ ਹਾਂ ਠੀਕ ਓਕੇ ਬਾਏ